ਵਿਆਹਵਾਂ ਵਰਗੇ ਵੱਡੇ ਸਮਾਰੋਹ ਵਿੱਚ ਪਾਣੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਖਾਣਾ ਬਣਾਉਣ ਲਈ ਪੀਣ ਲਈ ਪਾਣੀ ਚਾਹੀਦਾ ਹੁੰਦਾ ਹੈ ਅਤੇ ਇੰਨੀ ਜ਼ਿਆਦਾ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਿੱਥੋਂ ਹੋ ਸਕਦਾ ਹੈ ਵਿਆਹ ਸ਼ਾਦੀਆਂ ਵਾਸਤੇ ਨਗਰ ਪਾਲਿਕਾ ਦੇ ਟੈਂਕਰ ਤੋਂ ਪਾਣੀ ਮੰਗਵਾਇਆ ਜਾ ਸਕਦਾ ਹੈ ਅਤੇ ਜਾਂ ਪ੍ਰਾਈਵੇਟ ਫਰਮਾਂ ਦੇ ਟੈਂਕਰ ਪਾਣੀ ਵਾਲੇ ਟੈਂਕਰ ਵੀ ਮੁਹੱਈਆ ਕਰਵਾਏ ਜਾ ਸਕਦੇ ਹਨ ਅਤੇ ਪੀਣ ਵਾਸਤੇ ਪਾਣੀ ਬਜ਼ਾਰ ਵਿੱਚੋਂ ਮੁੱਲ ਖਰੀਦਿਆ ਜਾਂਦਾ ਹੈ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਪਾਣੀ ਦੇ ਟੈਂਕਰ ਮੁਹੱਈਆ ਕਰਵਾ ਦਿੰਦੀਆਂ ਹਨ ਇਸ ਤਰ੍ਹਾਂ ਵਿਆਹ ਸ਼ਾਦੀਆਂ ਵਾਸਤੇ ਪਾਣੀ ਦਾ ਪ੍ਰਬੰਧ ਕਰ ਲਿਆ ਜਾਂਦਾ ਹੈ